ਮੈਂ ਫ਼ਾਜ਼ਿਲਕਾ ਦੇ ਵਿੱਚ ਸ਼ਿਲਪਕਾਰੀ ਜੁੱਤੀ ਇਹਨਾਂ ਚੀਜ਼ਾਂ ਦੀ ਦੱਸਣਾ ਚਾਹੁੰਦੀ ਤੁਹਾਨੂੰ ਕਿ ਫ਼ਾਜ਼ਿਲਕਾ ਦੀ ਜੁੱਤੀ ਕਾਫ਼ੀ ਮਸ਼ਹੂਰ ਹੈ ਅਤੇ ਇਹ ਕਾਫ਼ੀ ਵਿਦੇਸ਼ਾਂ ਵਿੱਚ ਜਾਂਦੀ ਹੈ ਅਤੇ ਇਹ ਪੰਜਾਬੀ ਸੂਟ 'ਤੇ ਜਿਵੇਂ ਰਾਜਸਥਾਨੀ ਸੂਟ 'ਤੇ ਅਤੇ ਕਾਫ਼ੀ ਅੱਛੀ ਲੱਗਦੀ ਹੈ ਪੰਜਾਬੀ ਸੂਟ 'ਤੇ ਪੰਜਾਬੀ ਜੁੱਤੀ ਰਾਜਥਾਨੀ ਰਾਜਸਥਾਨੀ ਸੂਟ 'ਤੇ ਰਾਜਸਥਾਨੀ ਜੁੱਤੀ ਕਲਰਫੁਲ ਜੁੱਤੀ ਅਤੇ ਇਹਨਾਂ 'ਤੇ ਰੰਗ ਬਿਰੰਗੀ ਨਕਾਸ਼ੇਬਾਜੀ ਮਤਲਬ ਵੀ ਜੇ ਕੋਈ ਮੋਤੀ ਵਾਲੀ ਜੁੱਤੀ ਹੁੰਦੀ ਜਿਵੇਂ ਅਤੇ ਨੌਕਦਾਰ ਜੁੱਤੀ ਅਤੇ ਸਿੰਪਲ ਜੁੱਤੀ ਵੀ ਬਣਾਈ ਜਾਂਦੀ ਏ ਅਤੇ ਇਹ ਕਾਫ਼ੀ ਅੱਛੀ ਲੱਗਦੀ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਾਂਦੀ ਇਹ ਜੁੱਤੀ ਅਤੇ ਰਾਜਸਥਾਨ ਹਰਿਆਣਾ ਹਰ ਤਰ੍ਹਾਂ ਦੇ ਦੇਸ਼ ਦੇ ਵਿੱਚ ਫ਼ਾਜ਼ਿਲਕਾ ਦੀ ਜੁੱਤੀ ਕਾਫ਼ੀ ਮਸ਼ਹੂਰ ਹੈ ਇੱਥੋਂ ਤੱਕ ਕਿ ਫਿਲਮਾਂ ਗਾਣਿਆਂ ਦੇ ਵਿੱਚ ਵੀ ਫ਼ਾਜ਼ਿਲਕਾ ਦੀ ਜੁੱਤੀ ਦਾ ਕਾਫ਼ੀ ਨਾਮ ਆਇਆ ਹੈ ਅਤੇ ਸ਼ਿਲਪਕਾਰੀ ਜਿੱਥੋਂ ਤੱਕ ਕਹੀ ਜਾਵੇ ਸ਼ਿਲਪਕਾਰੀ ਅਤੇ ਲੱਕੜ ਜਾਂ ਮਤਲਬ ਕਿ ਘੁਮਿਆਰ ਜਿਹੜੇ ਘੜੇ ਬਣਾਉਂਦੇ ਨੇ ਉਹਨਾਂ 'ਤੇ ਵੀ ਕਾਫ਼ੀ ਅੱਛੀ ਸ਼ਿਲਪਕਾਰੀ ਬੜੀ ਪਿਆਰੀ ਚੀਜ਼ ਵੇਖਣ ਨੂੰ ਇੱਥੇ ਮਿਲਦੀ ਹੈ ਕਾਫ਼ੀ ਮਸ਼ਹੂਰ ਹੈ ਸ਼ਿਲਪਕਾਰੀ ਕੜੇ ਜਾਂ ਕਿਵੇਂ ਹੋਰ ਮੂਰਤੀਕਾਰ ਜਿਵੇਂ ਬਣਾਉਣ ਦੇ ਵਿੱਚ ਬਹੁਤ ਹੀ ਅੱਛੀ ਮਤਲਬ ਵੀ ਇੱਥੋਂ ਦੀ ਸ਼ਿਲਪਕਾਰੀ ਕਾਫ਼ੀ ਮਸ਼ਹੂਰ ਹੈ ਇੱਥੋਂ ਦੀ